ਹੈਲੋ ਸਰ ਸਵਿਗੀ ਤੋਂ ਬੋਲਦੇ ਅਸੀਂ ਤੁਹਾਡੇ ਕੋਲ ਔਡਰ ਕੀਤਾ ਸੀ ਛੋਲੇ ਪਨੀਰ ਮਟਰ ਪਨੀਰ ਦਾਲ ਸ਼ ਸ਼ਾਹੀ ਪਨੀਰ ਕੁਲਚੇ ਰੋਟੀਆਂ ਕੋਲ ਡਰਿੰਕਸ ਸਵੀਟਸ ਕੇਕ ਪੀਜਾ ਜੋ ਕਿ ਹੁਣ ਕਿਸੇ ਕਾਰਨ ਸਾ ਸਾਨੂੰ ਨਹੀਂ ਚਾਹੀਦਾ ਅਸੀਂ ਔਡਰ ਰੱਦ ਕੀਤਾ ਹੋਇਆ ਹੈ ਸਾਡਾ ਭੁਗਤਾਨ ਦੋ ਹਜ਼ਾਰ ਰੁਪਏ ਦਾ ਸੀ ਜੋ ਰਿਫੰਡ ਨਹੀਂ ਹੋ ਰਿਹਾ ਕਿਰਪਾ ਕਰਕੇ ਸਾਡਾ ਭੁਗਤਾਨ ਰੀਫੰਡ ਕੀਤਾ ਜਾਵੇ ਜਾਂ ਫਿਰ ਸਾਨੂੰ ਕਾਰਨ ਦੱਸਿਆ ਜਾਵੇ ਕਿ ਕਿਸ ਕਾਰਨ ਰਿਫੰਡ ਬੈਕ ਨਹੀਂ ਹੋ ਰਿਹਾ ਨਹੀਂ ਤਾਂ ਸਾਨੂੰ ਕੋਈ ਜਵਾਬ ਦਿੱਤਾ ਜਾਵੇ ਅਸੀਂ ਬਣਦੀ ਕਾਰਵਾਈ ਕਰੀਏ ਸਾਡਾ ਰਿਫੰਡ ਬੈਕ ਕੀਤਾ ਜਾਵੇ ਕਿਰਪਾ ਕਰਕੇ ਸਰ ਬੇਨਤੀ ਹੈ ਰੀਫੰਡ ਬੈਕ ਕਰੋ ਨਹੀਂ ਤਾਂ ਬਣਦੀ ਕਾਰਵਾਈ ਕਰਨੀ ਪਵੇਗੀ